ਦੋ ਅਕਤੂਬਰ ਵੀਹ ਸੌ ਪੰਦਰਾਂ ਸਤਾਈ ਜਲਾਈ ਉੱਨੀ ਸੌ ਸਤਾਸੀ ਪੰਦਰਾਂ ਨਵੰਬਰ ਉੱਨੀ ਸੌ ਅਠਾਸੀ ਪੰਦਰਾਂ ਅਗਸਤ ਉੱਨੀ ਸੌ ਪੰਝੱਤਰ ਤਿੰਨ ਮਾਰਚ ਉੱਨੀ ਸੌ ਪਚਾਸੀ